ਸਤਿ ਸ਼੍ਰੀ ਅਕਾਲ ਸਰ ਰਾਮ ਢਾਬੇ ਤੋਂ ਬੋਲ ਰਹੇ ਹੋ ਜੀ ਮੈਂ ਸੁਮਨ ਇੱਕ ਸੌ ਇੱਕ ਹਾਊਸ ਨੰਬਰ ਗੁਰੂ ਅੰਗਦ ਨਗਰ ਤੋਂ ਬੋਲ ਰਹੀ ਹਾਂ ਜਿੱਦਾਂ ਕਿ ਤੁਹਾਨੂੰ ਪਤਾ ਮੈਂ ਪਹਿਲਾਂ ਵੀ ਤੁਹਾਡੇ ਤੋਂ ਔਡਰ ਕਰਦੀ ਰਹਿੰਦੀ ਹਾਂ ਅਤੇ ਮੇਰੀ ਪੇਮੈਂਟ ਆਟੋਮੈਟਿਕ ਕੱਟ ਹੋ ਜਾਂਦੀ ਹੈ ਇੱਦਾਂ ਅੱਜ ਵੀ ਮੈਂ ਇੱਕ ਔਡਰ ਕੀਤਾ ਸੀ ਜਿਹਦੇ ਵਿੱਚ ਮਿਕਸ ਵੈਜ ਕੜੀ ਚਾਵਲ ਸ਼ਾਹੀ ਪਨੀਰ ਅਤੇ ਚਾਰ ਰੋਟੀਆਂ ਸੀ ਕਿਸੇ ਕਾਰਨ ਕਰਕੇ ਮੈਨੂੰ ਅੱਜ ਔਫਿਸ ਦੇ ਕੰਮ ਲਈ ਬਾਹਰ ਜਾਣਾ ਪੈ ਰਿਹਾ ਇਸ ਕਰਕੇ ਮੈਂ ਇਹ ਔਡਰ ਰਿਸੀਵ ਨਹੀਂ ਕਰ ਸਕਦੀ ਕਿਰਪਾ ਕਰਕੇ ਔਡਰ ਕੈਂਸਲ ਕਰ ਦਿਉ ਅਤੇ ਮੇਰੀ ਪੇਮੈਂਟ ਰਿਫੰਡ ਕਰ ਦਿਉ ਜਾਂ ਤਾਂ ਗੂਗਲ ਪੇ ਕਰ ਦਿਉ ਜਾਂ ਫਿਰ ਕੈਸ਼ ਕਰ ਦਿਉ ਧੰਨਵਾਦ